ਹੈਲੋ ਹਾਂਜੀ ਸੁਰਿੰਦਰ ਭਾਅ ਜੀ ਓਲਾ ਊਬਰ ਤੋਂ ਬੋਲਦੇ ਹੈ ਹਾਂਜੀ ਹਾਂਜੀ ਭਾਅ ਜੀ ਮੈਂ ਨਿਰਮਲ ਸਿੰਘ ਬੋਲ ਰਿਹਾ ਇੱਥੇ ਪ੍ਰੇਮ ਨਗਰ ਤੋਂ ਹਾਂਜੀ ਰੋਪੜ ਦੇ ਕੋਲ਼ ਹਾਂਜੀ ਹਾਂਜੀ ਭਾਅ ਜੀ ਮੈਂ ਨਾ ਜੰਮੂ ਜਾਣਾ ਹੈਗਾ ਪੱਚੀ ਤਰੀਕ ਨੂੰ ਮੈਰਿਜ ਅਤੇ ਉਹਦੇ ਵਾਸਤੇ ਨਾ ਮੈਂ ਗੱਡੀ ਬੁੱਕ ਕਰਨੀ ਸੀਗੀ ਫਿਰ ਮੈਂ ਨੰਬਰ ਤੁਹਾਡਾ ਇਹਦੇ ਵਿੱਚ ਸ਼ੋਅ ਹੋਇਆ ਹੈਗਾ ਮੋਬਾਈਲ ਵਿੱਚ ਤਾਂ ਕਰਕੇ ਮੈਂ ਤੁਹਾਨੂੰ ਕੋਲ ਲਗਾਈ ਹੈ ਹਾਂਜੀ ਪੱਚੀ ਤਰੀਕ ਤੋਂ ਮੈਂ ਮਤਲਬ ਪੰਜ ਛੇ ਦਿਨ ਲੱਗ ਜਾਣੇ ਉੱਧਰ ਅਤੇ ਭਾਅ ਜੀ ਮੈਨੂੰ ਡਰਾਈਵਰ ਮਤਲਬ ਨਸ਼ੇ ਵਾਲ਼ਾ ਨਹੀਂ ਚਾਹੀਦਾ ਕਿਉਂਕਿ ਫੈਮਿਲੀ ਦੇ ਵਿੱਚ ਜਾਣਾ ਆਪਾਂ ਮੈਰਿਜ ਦੇ ਵਿੱਚ ਵੀ ਜਾਣਾ ਉੱਥੇ ਅਤੇ ਦੋ ਤਿੰਨ ਦਿਨ ਮੈਰਿਜ ਦੇ ਹੈ ਉਸ ਤੋਂ ਬਾਅਦ ਮੈਰਿਜ ਤੋਂ ਬਾਅਦ ਫਿਰ ਰਿਸ਼ਤੇਦਾਰੀ 'ਚ ਵੀ ਜਾਣਾ ਤਿੰਨ ਚਾਰ ਦਿਨ ਉੱਥੇ ਵੀ ਪ੍ਰੋਗਰਾਮ ਹੈ ਅਤੇ ਘੁੰਮਣਾ ਫਿਰਨਾ ਵੀ ਅੱਗੇ ਵੀ ਹੋ ਸਕਦਾ ਇਸ ਕਰਕੇ ਮਤਲਬ ਨਸ਼ੇ ਵਾਲ਼ਾ ਡਰਾਈਵਰ ਨਾ ਹੋਵੇ ਕੋਈ ਅਤੇ ਗੱਡੀ ਆਪਾਂ ਨੂੰ ਚਾਹੀਦੀ ਹੈ ਜੀ ਨਾਈਨ ਸੀਟਰ ਵੱਡੀ ਗੱਡੀ ਚਾਹੀਦੀ ਹਾਂਜੀ ਹਾਂਜੀ ਹਾਂਜੀ ਅਤੇ ਉਸ ਤੋਂ ਬਾਅਦ ਭਾਅ ਜੀ ਪੇਮੈਂਟ ਦਾ ਕਿਸ ਤਰ੍ਹਾਂ ਜੀ ਨਗਦ ਜਾਂ ਕੈਸ਼ ਉਹ ਦੂਸਰਾ ਔਨਲਾਈਨ ਤਾਂ ਮੈਂ ਕਰਨੀ ਨਹੀਂ ਹੈ ਹਾਂ ਤੁਸੀਂ ਕੈਸ਼ ਲੈ ਲਿਓ ਕੈਸ਼ ਦਾ ਕੋਈ ਚੱਕਰ ਨਹੀਂ ਹੈ ਅੱਛਾ ਡਰਾਈਵਰ ਦਾ ਕੋਈ ਗੱਲ ਨਹੀਂ ਡਰਾਈਵਰ ਨੂੰ ਦੇ ਦੂਗੇ ਪੰਜ ਸੌ ਰੁਪਇਆ ਜਿਹੜਾ ਨਾਈਟ ਦਾ ਪੈਂਦਾ ਉਹ ਵੀ ਦੇ ਦਿਆ ਕਰਾਂਗੇ ਕੋਈ ਚੱਕਰ ਨਹੀਂ ਹੈ ਉਹ ਕੋਈ ਗੱਲ ਨਹੀਂ ਜੀ ਉਹ ਕਿਲੋਮੀਟਰ ਤੋਂ ਇਲਾਵਾ ਹਾਂ ਹਾਂ ਹਾਂ ਕੋਈ ਦਿੱਕਤ ਨਹੀਂ ਕਿਲੋਮੀਟਰ ਤੋਂ ਇਲਾਵਾ ਮਿਲ ਜਾਵੇਗਾ ਬਾਕੀ ਨਸ਼ਾ ਨਾ ਕਰਦਾ ਹੋਏ ਹੋਰ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਹੈ ਠੀਕ ਹੈ ਕੈਸ਼ ਕੈਸ਼ ਪੇਮੈਂਟ ਕਰ ਦੂਗੇ ਇੱਥੇ ਘਰ ਆ ਕੇ ਵਾਪਸੀ ਠੀਕ ਹੈ ਜੇ ਤੇਲ ਪਵਾਉਣਾ ਹੋਇਆ ਰਸਤੇ 'ਚ ਪਵਾ ਦੂਗੇ ਕੋਈ ਚੱਕਰ ਨਹੀਂ ਹੈ ਟੂਲ ਟੈਕਸ ਦੀ ਪਰਚੀ ਹੋਈ ਹਾਂ ਉਹ ਵੀ ਦੇ ਦਿਆਂਗੇ ਉਹਦਾ ਵੀ ਕੋਈ ਚੱਕਰ ਨਹੀਂ ਹੈ ਉਹ ਵੀ ਦੇ ਦੂਗੇ ਠੀਕ ਹੈ ਠੀਕ ਹੈ